ਧਰਮਾਂ ਦੇ ਨਾਲ ਸੰਬੰਧਿਤ ਵਿਵਾਦ ਬਹੁਤ ਬਹੁਤ ਮੁੱਦੇ ਹਨ ਜਿਵੇਂ ਕਿ ਹਿੰਦੂ ਸਿੱਖ ਈਸਾਈ ਅਤੇ ਮੁਸਲਿਮ ਇਹ ਅਲੱਗ ਅਲੱਗ ਧਰਮ ਦੇ ਧਰਮ ਹਨ ਅਤੇ ਹਰ ਕੋਈ ਆਪਣੇ ਆਪਣੇ ਧਰਮ ਨੂੰ ਕੱਟੜ ਹੈ ਜਿਵੇਂ ਕਿ ਹਿੰਦੂ ਜਿਵੇਂ ਉਸਨੇ ਕੋਈ ਨਾਮਦਾਨ ਲਿਆ ਹੈ ਅਤੇ ਉਹ ਕੁਛ ਐਦਾਂ ਦਾ ਗਲਤ ਨਾ ਖਾ ਪੀ ਸਕੇ ਨਾ ਕਿਸੇ ਦੀ ਚੁਗਲੀ ਨਿੰਦਾ ਕਰ ਸਕੇ ਅਤੇ ਮੁਸਲਮਾਨ ਆਪਣੇ ਮੁਸਲਿਮ ਲੈ ਕੇ ਧਰਮ ਨੂੰ ਲੈ ਕੇ ਬਹੁਤ ਹੀ ਕੱਟੜ ਹਨ ਜਿਸਨੂੰ ਕਿ ਆਪਣੇ ਉਹ ਆਪਣਾ ਹੀ ਖਾਂ ਆਪਣਾ ਹੀ ਖਾਂਦੇ ਖਾਂਦੇ ਪੀਂਦੇ ਹਨ ਜਿਵੇਂ ਕਿ ਜਿੱਦਾਂ ਕਿ ਸਾਡੇ ਹਿੰਦੂ ਧਰਮ 'ਚ ਹੁੰਦਾ ਹੈ ਜਿੱਦਾਂ ਲੰਗਰ ਲੱਗਾ ਹੈ ਜਾਂ ਈਸਾਈ ਧਰਮ 'ਚ ਵੀ ਲੰਗਰ ਲੱਗਾ ਹੈ ਤਾਂ ਇੱਕ ਦੂਜੇ ਦਾ ਅਸੀਂ ਖਾ ਸਕਦੇ ਹਾਂ ਬਟ ਜਿਹੜੇ ਮੁਸਲਿਮ ਹੈ ਜਾਂ ਸਿੱਖ ਈਸਾਈ ਸਿੱਖ ਮੁਸਲਿਮ ਹੈ ਜਾਂ ਈਸਾਈ ਹੈ ਇਹ ਇੱਕ ਦੂਸਰੇ ਦਾ ਨਹੀਂ ਖਾਂਦੇ ਹੈ ਆਪਣੇ ਧਰਮ ਨੂੰ ਇਹ ਪੂਰੇ ਕੱਟੜ ਹਨ ਜਿਸ ਤਰ੍ਹਾਂ ਕਿ ਆਪਣੇ ਆਪਣੇ ਹੁਣ ਜਿੱਦਾਂ ਇਲੈਕਸ਼ਨ ਹੁੰਦੇ ਹਨ ਜਾਂ ਆਪਣੇ ਰੈਲੀਆਂ ਨਿਕਲਦੀਆਂ ਹਨ ਉਸ ਵਿੱਚ ਇਹ ਪੂਰਾ ਆਪਣਾ ਸਹਿਯੋਗ ਨਹੀਂ ਦਿੰਦੇ ਹਨ ਜਿਹਨੂੰ ਕਿ ਇਹ ਇਹ ਸਮਝਦੇ ਹਨ ਕਿ ਅਸੀਂ ਮੁਸਲਮਾਨ ਹਾਂ ਅਸੀਂ ਆਪਣਾ ਹੀ ਧਰਮ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਬਟ ਹਰ ਇਹ ਰਲ ਮਿਲ ਕੇ ਨਹੀਂ ਰਹਿੰਦੇ ਹਨ ਇਸ ਇਹ ਤਾਂ ਆਪਣਾ ਪੂਰਾ ਆਪਣੇ ਧਰਮ ਦਾ ਪਾਲਣ ਕਰਦੇ ਹਨ ਜਿਵੇਂ ਕਿ